ਹੈਲੋ ਮੈਂ ਲੋਕਲ ਏਰੀਆ ਤੋਂ ਗੱਲ ਕਰ ਰਹੀ ਹਾਂ ਮੈਂ ਕੱਲ ਹੀ ਤੁਹਾਡੇ ਹੋਟਲ ਤੋਂ ਆਰਡਰ ਕਰਵਾਇਆ ਸੀ ਦੱਸ ਪੰਦਰਾਂ ਥਾਲੀਆਂ ਦਾ ਪਰ ਪਹਿਲਾਂ ਤਾਂ ਉਹ ਆਰਡਰ ਘਰ ਵਿੱਚ ਬਹੁਤ ਲੇਟ ਆਇਆ ਅਤੇ ਫਿਰ ਜਦੋਂ ਮੈਂ ਅਤੇ ਮੇਰਾ ਪਰਿਵਾਰ ਖਾਣਾ ਖਾਣ ਲਈ ਬੈਠੇ ਅਤੇ ਜਿਵੇਂ ਹੀ ਤੁਹਾਡਾ ਪੈਕ ਖੋਲਿਆ ਤਾਂ ਉਹਦੇ ਵਿੱਚ ਮਰਿਆ ਹੋਇਆ ਕੌਕਰੋਚ ਮਿਲਿਆ ਅਸੀਂ ਸਾਰੇ ਬਹੁਤ ਜ਼ਿਆਦਾ ਹੈਰਾਨ ਹੋਏ ਵੀ ਤੁਹਾਡੀ ਸਰਵਿਸ ਇੰਨੀ ਜ਼ਿਆਦਾ ਗੰਦੀ ਹੋ ਕਿਵੇਂ ਹੋ ਸਕਦੀ ਹੈ ਮੈਨੂੰ ਉਮੀਦ ਨਹੀਂ ਸੀ ਵੀ ਇੰਨੀ ਜ਼ਿਆਦਾ ਗੰਦੀ ਸਰਵਿਸ ਤੁਹਾਡੇ ਹੋਟਲ ਦੀ ਹੋਊਗੀ ਜੇ ਅਸੀਂ ਮੈਂ ਅਤੇ ਮੇਰਾ ਪੂਰਾ ਪਰਿਵਾਰ ਇਹ ਖਾਣਾ ਖਾ ਲੈਂਦਾ ਤਾਂ ਕੀ ਅਸਰ ਹੁੰਦਾ ਕੋਈ ਬਿਮਾਰ ਪੈ ਜਾਂਦਾ ਕਿਸੇ ਦੀ ਸਿਹਤ ਖ਼ਰਾਬ ਹੋ ਜਾਂਦੀ ਤੁਹਾਨੂੰ ਤੁਹਾਨੂੰ ਇਸਦਾ ਪੂਰਾ ਧਿਆਨ ਰੱਖਣਾ ਚਾਹੀਦਾ ਤੁਹਾਡੀ ਸਰਵਿਸ ਦੇ ਵਿੱਚ ਬਹੁਤ ਜ਼ਿਆਦਾ ਲਾਪਰਵਾਹੀ ਹੋਈ ਮੈਂ ਤਾਂ ਤੁਹਾਡੇ ਹੋਟਲ ਦੀ ਆਪਣੇ ਮਾਪਿਆਂ ਸਾਹਮਣੇ ਇੰਨੀ ਵਡਿਆਈ ਕੀਤੀ ਸੀ ਵੀ ਉਥੇ ਤਾਂ ਬਹੁਤ ਬੈਸਟ ਹੈ ਬੀ ਬਹੁਤ ਜ਼ਿਆਦਾ ਵਧੀਆ ਹੈ ਹੋਟਲ ਖਾਣਾ ਪੀਣਾ ਸਭ ਕੁੱਝ ਬਹੁਤ ਵਧੀਆ ਮਿਲਦਾ ਹੈ ਅਤੇ ਤੁਸੀਂ ਇੱਕ ਵਾਰ ਪਲੀਜ਼ ਆਪਣੇ ਹੋਟਲ ਦੀ ਜਾਂਚ ਪੜ੍ਤਾਲ ਕਰਵਾਓ ਜਿੱਥੇ ਖਾਣਾ ਬਣ ਰਿਹਾ ਮੇਰੇ ਜਿੱਦਾਂ ਦੇ ਬਹੁਤ ਸਾਰੇ ਕਸਟਮਰ ਹੋਣਗੇ ਜਿੰਨਾਂ ਨੇ ਇਹ ਖਾਣਾ ਲਿਆ ਹੋਣਾ ਅਤੇ ਉਹਨਾਂ ਨੇ ਤਾਂ ਦੇਖਿਆ ਵੀ ਨਹੀਂ ਹੋਣਾ ਅਤੇ ਤੁਸੀਂ ਸੋਚੋ ਜੇ ਕਿਸੇ ਦੀ ਸਿਹਤ ਖ਼ਰਾਬ ਹੋ ਗਈ ਤਾਂ ਫਿਰ ਕਿ ਕਿੰਨਾ ਬੁਰਾ ਅਸਰ ਹੋਊਗਾ ਇਸ ਲਈ ਕਿਰਪਾ ਕਰਕੇ ਤੁਸੀਂ ਪਹਿਲਾਂ ਆਪਣੇ ਹੋਟਲ ਦੀ ਜਾਂਚ ਪੜ੍ਤਾਲ ਕਰਵਾਓ ਅਤੇ ਮੈਂ ਤਾਂ ਤੁਹਾਡੇ ਪਹਿਲਾਂ ਹੀ ਸਾਰੇ ਵੀ ਔਨਲਾਈਨ ਪੇਮੈਂਟ ਕਰ ਦਿੱਤੀ ਸੀ ਖਾਣੇ ਦੀ ਅਤੇ ਇਸ ਲਈ ਬੇਨਤੀ ਹੈ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਸਾਰੇ ਪੈਸੇ ਰਿਫੰਡ ਕੀਤੇ ਜਾਣ ਜੇ ਤੁਸੀਂ ਇਦਾਂ ਨਾ ਕਰਿਆ ਤਾਂ ਫਿਰ ਮੈਂ ਤੁਹਾਡੇ ਉੱਪਰ ਕਾਰਵਾਈ ਕਰੂੰਗੀ